ਸਾਡੇ ਇਲਾਕੇ ਵਿੱਚ ਇੱਕ ਸਰਕਾਰੀ ਡਿਸਪੈਂਸਰੀ ਹੈ ਜਿੱਥਾ ਜਿੱਥੇ ਦੇ ਡਾਕਟਰ ਬਹੁਤ ਵਧੀਆ ਹੈ ਉਹ ਆਪਣੇ ਤਰਫੋਂ ਪੂਰੀ ਕੋਸ਼ਿਸ਼ ਕਰਦੇ ਹਾ ਕਿ ਬੱਚਿਆਂ ਨੂੰ ਵੱਧ ਤੋਂ ਵੱਧ ਜਾਣਕਾਰੀ ਦਿੱਤੀ ਜਾਵੇ ਜਿਵੇਂ ਕਿ ਉਹ ਜਿਹੜੇ ਵਿਦਿਆਰਥੀ ਜੀ ਐਨ ਐਮ ਕਰਦੇ ਹਨ ਜਾਂ ਫਿਰ ਬੀਐਸਸੀ ਨਰਸਿੰਗ ਕਰਦੇ ਹਨ ਉਹਨਾਂ ਨੂੰ ਦੱਸਦੇ ਹੈ ਕਿ ਕਿੱਦਾਂ ਇੱਕ ਮਰੀਜ਼ ਦੇ ਹੱਥਾਂ ਵਿੱਚ ਸੂਈ ਲਗਾਈ ਜਾਵੇ ਹੋਰ ਵੀ ਉਹਨਾਂ ਨੂੰ ਬਹੁਤ ਸਾਰੀਆਂ ਚੀਜ਼ਾਂ ਦੱਸਦੇ ਹਨ ਡਾਕਟਰ ਅਤੇ ਨਰਸਾਂ ਵਿਦਿਆਰਥੀਆਂ ਦੀ ਮਦਦ ਕਰਦੇ ਹਨ ਤਾਂ ਕਿ ਉਹ ਆਪਣੇ ਖੇਤਰ ਵਿੱਚ ਅੱਗੇ ਤੋਂ ਅੱਗੇ ਵਧੇ ਅਤੇ ਆਪਣੇ ਘਰਦਿਆਂ ਦਾ ਨਾਮ ਰੋਸ਼ਨ ਕਰੇ ਇਹ ਸਭ ਤੋਂ ਵਧੀਆ ਗੱਲ ਹੈ ਸਾਡੇ ਇਲਾਕੇ ਦੀ ਕਿ ਇੱਥੇ ਕੋਈ ਕਿਸੇ ਨੂੰ ਵੀ ਕੋਈ ਵੀ ਸਮੱਸਿਆ ਹੁੰਦੀ ਹੈ ਤਾਂ ਕੋਈ ਨਾ ਕੋਈ ਮਦਦ ਕਰਨ ਲਈ ਸਭ ਤੋਂ ਅੱਗੇ ਆਉਂਦਾ ਹੈ ਜਿਵੇਂ ਕਿ ਅਗਰ ਸਾਡੇ ਸਾਰਿਆਂ ਨੂੰ ਪਤਾ ਹੋਵੇਗਾ ਕਿ ਇਹ ਚੀਜ਼ ਕਿੱਦਾਂ ਹੁੰਦੀ ਹੈ ਜਿੱਦਾਂ ਕੋਈ ਵੀ ਬਿਮਾਰ ਹੋ ਜਾਵੇ ਤਾਂ ਸਾਡੇ ਇਲਾਕੇ ਦੇ ਕਿਸੇ ਨੂੰ ਵੀ ਪਤਾ ਹੋਏਗਾ ਕਿ ਇੰਜੈਕਸ਼ਨ ਕਿੱਦਾਂ ਲੱਗਦਾ ਹੈ ਤਾਂ ਕੋਈ ਸਹਾਇਤਾ ਕਰ ਸਕਦਾ ਹੈ ਜਾਂ ਕੋਈ ਦਵਾਈ ਦੇ ਸਕਦਾ ਹੈ ਇਹ ਬਹੁਤ ਜ਼ਰੂਰੀ ਹੈ ਨਾ ਇਸ ਬਾਰੇ ਜਾ ਜਾਗਰੂਕਤਾ ਹੋਣਾ ਵੀ ਬਹੁਤ ਜ਼ਰੂਰੀ ਹੈ